ਰੂਪਨਗਰ ਜ਼ਿਲ੍ਹੇ ਦੇ ਵਿੱਚ ਹਲਕਾ ਰੋਪੜ ਹਲਕਾ ਅਨੰਦਪੁਰ ਸਾਹਿਬ ਹਲਕਾ ਕੀਰਤਪੁਰ ਸਾਹਿਬ ਹਲਕਾ ਕੁਰਾਲੀ ਵੀ ਹੈ ਅਤੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਦਾ ਐਮ ਐਲ ਏ ਦਨੇਸ਼ ਚੱਢਾ ਹੈ ਅਤੇ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਅਤੇ ਉਹਦਾ ਚੀਫ ਮਨਿਸਟਰ ਭਗਵੰਤ ਮਾਨ ਹੈਗਾ ਹੈ ਅਤੇ ਇਹਨਾਂ ਦੇ ਵਿੱਚ ਆਪਸੀ ਬਣਤਰ ਜਿਹੜੀ ਸ ਸੈਂਟਰ ਦੇ ਨਾਲ ਬਣਦੀ ਹੈ ਅਤੇ ਉਹਨਾਂ ਨੇ ਵੀ ਜ਼ਿਲ੍ਹੇ ਦੇ ਲਈ ਕਾਫੀ ਫਿਲਹਾਲ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆਈ ਆ ਉਹਨੇ ਜ਼ਿਲ੍ਹੇ ਦਾ ਜਿਹੜਾ ਬਿਜਲੀ ਦਾ ਬਿਲ ਹੈ ਉਹ ਬਿਲਕੁਲ ਜੀਰੋ ਕਰ ਦਿੱਤਾ ਹੈ ਛੇ ਸੌ ਯੂਨਿਟਾਂ ਦੇ ਲਈ ਅਤੇ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ ਅਤੇ ਉਸ ਤੋਂ ਬਾਅਦ ਵੀ ਜਿਹੜੇ ਹਜੇ ਸਰਕਾਰੀ ਸਕੂਲ ਬਣਦੇ ਹਨ ਉਹ ਉਹਨਾਂ ਦੀ ਵੀ ਐਜ਼ੂਕੇਸ਼ਨ ਹੈ ਜਿਹੜੀ ਉਹ ਵੀ ਫਰੀ ਕਰ ਦਿੱਤੀ ਗਈ ਹੈ